ਟੈਕਨਾਲਜੀ ਨੇ ਨਿਊਜ਼ ਇੰਡਸਟਰੀ ਵਿੱਚ ਬਹੁਤ ਮਦਦ ਕੀਤੀ ਅੱਜ ਕੱਲ੍ਹ ਜਿਹੜੀਆਂ ਵੀ ਖਬਰਾਂ ਆਪਾਂ ਸਿਰਫ ਟੀ ਵੀ 'ਤੇ ਦੇਖਦੇ ਹੁੰਦੇ ਸੀਗੇ ਉਹ ਹੁਣ ਘਰ ਘਰ ਸੋਸ਼ਲ ਮੀਡੀਆ 'ਤੇ ਬੱਚਿਆਂ ਤੱਕ ਸਾਰੇ ਲਾ ਕੇ ਦੇਖ ਸਕਦੇ ਹਾਂ ਇਸ ਨਾਲ ਬਜ਼ੁਰਗ ਸਾਰੇ ਜਾਣੇ ਯਾਨੀ ਕਿ ਖਬਰਾਂ ਨੂੰ ਸੁਣ ਕੇ ਦੇਖ ਵੀ ਸਕਦੇ ਨੇ ਟੈਕਨੋਲਜੀ ਨਾਲ ਆਪਾਂ ਜਿਵੇਂ ਲੁਧਿਆਣੇ ਬੈਠੇ ਹੋਈਏ ਤਾਂ ਉੱਥੇ ਬਹਿ ਕੇ ਆਪਾਂ ਲੁਧਿਆਣੇ ਦੇ ਨਿਊਜ਼ ਐਂਕਰ ਨਾਲ ਗੱਲ ਕਰਨੀ ਹੋਵੇ ਉਹ ਵੀ ਖਬਰਾਂ ਪੁੱਛਣਾ ਅੱਜ ਕੱਲ੍ਹ ਬਹੁਤ ਆਸਾਨ ਹੋ ਗਿਆ ਹੈ ਉਹ ਵੀਡੀਓ ਕਾਲ ਕਰਕੇ ਸਾਨੂੰ ਸਾਰੀ ਖਬਰ ਦੱਸ ਦਿੰਦੇ ਹਨ ਆਪਾਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ ਵੀ ਮਿਲ ਜਾਂਦੀਆਂ ਨੇ ਸਾਨੂੰ ਅਖਬਾਰ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ ਪਹਿਲਾਂ ਬਜ਼ੁਰਗਾਂ ਨੂੰ ਐਨਕਾਂ ਲਗਾ ਕੇ ਅਖਬਾਰ ਪੜ੍ਹਨ ਦੀ ਲੋੜ ਹੁੰਦੀ ਸੀ ਅੱਜ ਕੱਲ੍ਹ ਤਾਂ ਟੀ ਵੀ ਉੱਤੇ ਉਹ ਸਿਰਫ ਆਪਾਂ ਸੁਣ ਕੇ ਵੀ ਉਹ ਦੇਖ ਸਕਦੇ ਨੇ ਅਤੇ ਰੇਡੀਓ ਵਗੈਰਾ ਦਾ ਕੰਮ ਚੱਕਿਆ ਗਿਆ ਹੈ ਸਾਨੂੰ ਅਖਬਾਰ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ ਘਰ ਬੈਠੇ ਹੀ ਬਜ਼ੁਰਗਾਂ ਨੂੰ ਅੱਜ ਕੱਲ੍ਹ ਤਾਂ ਆਪਣੇ ਨਾਲੇ ਅਖਬਾਰ ਦੇ ਰਾਹੀਂ ਜਿਵੇਂ ਹੁਣ

ਥੋੜ੍ਹਾ ਜਿਹਾ ਵਧੀਆ ਲੱਗਦਾ ਫੀਲ ਹੁੰਦਾ ਜਿਹੜੇ ਲੋਕ ਨਹੀਂ ਵੀ ਜਾ ਸਕਦੇ ਹੈਗੇ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਅਤੇ ਬਹੁਤ ਵਧੀਆ ਸੁਨਹਿਰੀ ਮੌਕਾ ਹੁੰਦਾ ਵਧੀਆ ਟੈਕਨੋਲਜੀ ਯਾਨੀ ਕਿ